ਮੇਰੇ ਬਚਪਨ ਦੀਆਂ ਸਭ ਤੋਂ ਮਨਮੋਹਕ ਯਾਦ ਮਨਮੋਹਕ ਯਾਦਾਂ ਇਹ ਹਨ ਕਿ ਜਿਵੇਂ ਅਸੀਂ ਇਕੱਠੇ ਸਕੂਲ ਵਿੱਚ ਸਕੂਲ ਦੀਆਂ ਸਹੇਲੀਆਂ ਨਾਲ ਇਕੱਠੇ ਜਾਂਦੇ ਸਨ ਇਕੱਠੇ ਖਾਣਾ ਖਾਂਦੇ ਸੀ ਜਿਸ ਨਾਲ ਕਿ ਸਾਡੇ ਵਿੱਚ ਏਕਤਾ ਦੀ ਭਾਵਨਾ ਬਣੀ ਰਹੀ ਸੀ ਅਤੇ ਹੁਣ ਵੀ ਅਸੀਂ ਜਦੋਂ ਇ ਇੰਨੀ ਦੇਰ ਬਾਅਦ ਮਿਲਦੇ ਹਾਂ ਅਤੇ ਸਾਡਾ ਸੇਮ ਉਵੇਂ ਦਾ ਹੀ ਬਿਹੇਵੀਅਰ ਹੁੰਦਾ ਹੈ ਅਤੇ ਅਸੀਂ ਇਕੱਠੇ ਹੀ ਖਾਂਦੇ ਪੀਂਦੇ ਹਾਂ ਅਤੇ ਇਕੱਠੇ ਰਹਿੰਦੇ ਹਾਂ ਅਤੇ ਅਸੀਂ ਸਕੂਲ ਵਿੱਚ ਸਕੂਲ ਵਿੱਚੋਂ ਸਾਡੀ ਸਕੂਲ ਦੀ ਟੀਮ ਖੋ ਖੋ ਵਿੱਚ ਗਈ ਸੀ ਜੋ ਕਿ ਅਸੀਂ ਮੁੱਲਾਂਪੁਰ ਸਕੂਲ ਵਿੱਚ ਤੀਜੇ ਸਥਾਨ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ ਖੋ ਖੋ ਵਿੱਚ ਇਸ ਕਰਕੇ ਸਾਨੂੰ ਹੁਣ ਤੱਕ ਵੀ ਯਾਦ ਰਹਿੰਦਾ ਹੈ ਕਿ ਅਸੀਂ ਇਕੱਠੀਆਂ ਸਹੇਲੀਆਂ ਗਈਆਂ ਸਨ ਅਤੇ ਅਸੀਂ ਕੋਈ ਨਾ ਕੋਈ ਸਥਾਨ ਲੈ ਕੇ ਆਈਆਂ ਸਨ